ਓ ਸਰ ਕੀ ਕਹਿੰਦੇ ਆ ਹਾਂ ਕੱਲ੍ਹ ਚਾਹ ਚਾਹ ਪੀ ਕੇ ਗਿਆ ਸੀ ਮੈਂ ਤੁਹਾਡੀ ਦੁਕਾਨ ਤੋਂ ਅਤੇ ਤੁਹਾਡਾ ਕੱਲ੍ਹ ਕੱਲ੍ਹ ਦੀ ਗੱਲ ਕਰਦਾ ਪਿਆਂ ਅਤੇ ਤੁਹਾਡਾ ਬੇਟਾ ਹੈਗਾ ਸੀ ਸਰ ਉਦੋਂ ਦੁਕਾਨ 'ਤੇ ਅਤੇ ਉਹਨੇ ਬਣਾਈ ਸੀ ਚਾਹ ਸਰ ਨਾ ਤਾਂ ਚਾਹ ਦਾ ਟੇਸਟ ਵਧੀਆ ਸੀਗਾ ਉੱਤੋਂ ਕੱਪ ਵੀ ਕੋਈ ਐਡੇ ਸਾਫ ਸੁਥਰੇ ਨਹੀਂ ਸੀ ਸਰ ਤੁਸੀਂ ਸਰ ਹਾਈਜੀਨ ਦਾ ਮਾੜਾ ਮੋਟਾ ਧਿਆਨ ਰੱਖਿਆ ਕਰੋ ਸਰ ਕੀ ਕਰਦੇ ਹੋ ਸਰ ਕੱਲ੍ਹ ਕੱਲ੍ਹ ਸਰ ਇਹੀਓ ਅੱਜ ਹੁਣ ਜਿਵੇਂ ਟਾਈਮ ਹੋਇਆ ਨਾ ਬਾਰ੍ਹਾਂ ਕੁ ਵਜੇ ਕੱਲ੍ਹ ਆਇਆ ਸੀ ਅਤੇ ਮੈਂ ਚਾਰ ਪੰਜ ਦਿਨ ਪੁਰਾਣੀ ਗੱਲ ਹੈ ਬੇਲੀਆਂ ਨਾਲ ਹੀ ਆਇਆ ਮੈਂ ਮੈਂ ਕਾਫੀ ਵਾਰੀ ਵੀ ਕੱਲ੍ਹ ਆ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਉਦੋਂ ਵੀ ਬੇਲੀ ਮੇਰੇ ਰਿਵਿਊ ਦਿੰਦੇ ਪਏ ਸੀ ਵੀ ਕੀ ਕਹਿੰਦੇ ਹਾਂ ਯਾਰ ਫਲਾਣੇ ਦੀ ਚਾਹ ਨਹੀਂ ਸਵਾਦ ਹੈਗੀ ਇਹਦੀ ਚਾਹ ਨਹੀਂ ਸਵਾਦ ਨਾ ਕੋਈ ਦੁਕਾਨ 'ਤੇ ਸਫਾਈ ਸਫੁਈ ਰੱਖਦਾ ਹੈ ਬੰਦਾ ਸਰ ਐਵੇਂ ਕਹਿੰਦੇ ਪਏ ਸੀ ਤੁਸੀਂ ਸਰ ਐਂਈਂ ਕਰੋ ਮਤਲਬ ਉਹਨੂੰ ਸਹੀ ਤਰ੍ਹਾਂ ਸਿਖਾਓ ਵੀ ਕਿਵੇਂ ਚਾਹ ਬਣਦੀ ਹੈ ਜਾਂ ਕਿਵੇਂ ਵੀ ਹੈ ਨਾ ਹਾਈਜੀਨ ਦਾ ਥੋੜ੍ਹਾ ਧਿਆਨ ਰੱਖਿਆ ਕਰੋ ਪੱਤੀ ਸਰ ਉਹਨੇ ਚਾਹ 'ਚ ਪਾਈ ਨਹੀਂ ਸੀ ਅੱਛਾ ਅੱਛਾ ਨਹੀਂ ਸਰ ਪਤਾ ਕੀ ਉਹਨੂੰ ਨਾ ਸਹੀ ਤਰ੍ਹਾਂ ਮੁੰਡੇ ਟ੍ਰੇਨਡ ਰੱਖਿਆ ਕਰੋ ਤੁਸੀਂ ਪਤਾ ਕੀ ਐਂ ਤੁਹਾਡਾ ਵੀ ਨੁਕਸਾਨ ਹੁੰਦਾ ਕਸਟਮਰ ਅਗਲਾ ਇੱਕ ਵਾਰੀ ਆਏਗਾ ਅਗਲੇ ਨੇ ਦੂਜੀ ਵਾਰੀ ਆਉਣਾ ਨਹੀਂ ਮੁੜ ਜਾਵੇਗਾ ਕਿਸੇ ਦੂਜੇ ਨੂੰ ਪੈਸੇ ਵਟਾਏਗਾ ਉਹ ਤੁਹਾਡਾ ਹੋਰ ਲੋਸ ਹੈ ਆਹੀ ਤੁਸੀਂ ਟਰੇਨਡ ਸਟਾਫ ਰੱਖੋਗੇ ਪੂਰੀ ਹਾਈਜੀਨ ਰੱਖੋਗੇ ਸਾਫ ਸਫਾਈ ਹੈ ਮੈਂ ਕਹਿੰਦਾ ਹਾਈਜੀਨ ਕਲੀਨੀਨੈਸ ਰੱਖੋਗੇ ਆਪਦੀ ਸ਼ੋਪ 'ਤੇ ਜਾਂ ਕੰਟੀਨ 'ਤੇ ਅਤੇ ਜੋ ਵੀ ਹੈ ਤਾਂ ਤੁਹਾਡੇ ਕਸਟਮਰ 'ਚ ਵੀ ਵਾਧਾ ਹੋਏਗਾ ਤ ਤੁਹਾਡੀ ਇਨਕਮ 'ਚ ਵੀ ਵਾਧਾ ਹੋਏਗਾ ਥੋੜ੍ਹਾ ਜਿਹਾ ਸਰ ਧਿਆਨ ਰੱਖਿਆ ਕਰੋ ਹੈਂ ਹੂੰ

ਕੋਈ ਨਹੀਂ ਕੋਈ ਨਹੀਂ ਸਰ ਨਾਲੇ ਸਰ ਸਮਾਨ ਸਮੁਨ ਵਾਹਵਾ ਰੱਖਿਆ ਕਰੋ ਦੁਕਾਨ 'ਚ ਸਮਾਨ ਹੀ ਨਹੀਂ ਹੈਗਾ ਸੀ ਖਾਲੀ ਕੰਟੀਨ ਪਈ ਤੁਹਾਡੀ ਸਮਾਨ ਸਮੁਨ ਵਾ ਵਰਾਈਟੀਆਂ ਵਰੂਟੀਆਂ ਵਾਹਵਾ ਰੱਖੋਗੇ ਨਾ ਤਾਂ ਹੀ ਕੋਈ ਕੰਮ ਬਣਨਾ ਐਂ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਗਾਹਕ ਮੁੜ ਜਾਂਦੇ ਨੇ ਹੈਂ ਅੱਜ ਕੱਲ੍ਹ ਵਾਹਵਾ ਸਾਰੀ ਦੁਕਾਨਾਂ ਨੇ ਮਾਰਕੀਟ 'ਚ ਹੈਂ ਇਹ ਵੀ ਮੈਂ ਕਹਿੰਦਾ ਨਾ ਕਸਟਮਰ ਜਿਹੜਾ ਹੁੰਦਾ ਸਾਨੂੰ ਪਤਾ ਵਰਾਇਟੀ ਮੰਗਦਾ ਜਿਹੜੇ ਦੁਕਾਨਦਾਰ ਕੋਲ ਵਰਾਇਟੀ ਹੋਏਗੀ ਕਸਟਮਰ ਨੇ ਉਹ ਦੁਕਾਨਦਾਰ ਵੱਲ ਹੀ ਅਟਰੈਕਟ ਹੋਣਾ ਅਤੇ ਉੱਥੇ ਜਾਣਾ ਤੁਹਾਨੂੰ ਪਤਾ ਫਿਰ ਤਾਜ਼ੀ ਸਰ ਤਾਜ਼ੀ ਪੱਤੀ ਰੱਖਿਆ ਕਰੋ ਉਸ ਦਿਨ ਮੈਂ ਵੇਖਿਆ ਤੁਹਾਡੀ ਖੰਡ 'ਤੇ ਕੀੜੀਆਂ ਚੜ੍ਹੀਆਂ ਹੋਈਆਂ ਸੀ ਉਹਨੇ ਧੁੱਪੇ ਰੱਖੀ ਸੀ ਖੰਡ ਸਰ ਐਂਈਂ ਨਹੀਂ ਕੰਮ ਚੱਲਣਾ ਤਾਜ਼ਾ ਗੱਟਾ ਮੰਗਵਾਇਆ ਤਾਜ਼ਾ ਤਾਜ਼ੀ ਪੱਤੀ ਸਾਰਾ ਕੁਛ ਦੁੱਧ ਤਾਜ਼ਾ ਮੰਗਵਾਇਆ ਸਵੇਰੇ ਸ਼ਾਮ ਜਿਵੇਂ ਵੀ ਹੈ ਸਾਰੇ ਪੂਰੀ ਹਾਈਜੀਨ ਰੱਖਣੀ ਹੈ

ਕੋਈ ਨਹੀਂ ਸਰ ਅਸੀਂ ਕਰਾਂਗੇ ਕੱਲ੍ਹ ਫਿਰ ਮੈਂ ਦੁਬਾਰਾ ਆ ਮੈਂ ਅਤੇ ਮੈਂ ਆਪਦੇ ਫਰੈਂਡਸ ਨੂੰ ਲੈ ਕੇ ਨਾ ਤੁਹਾਡੀ ਸ਼ੋਪ 'ਤੇ ਜ਼ਰੂਰ ਜਾਵਾਂਗਾ ਹੈਂ ਸਰ ਓਕੇ ਸਰ ਠੀਕ